ਮੇਰੇ ਲਈ ਸਭ ਤੋਂ ਅਣਕਿਆਸੀ ਚੀਜ਼ ਇਹ ਹੈ ਕਿ ਮੈਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਨੂੰ ਮੇਰੇ ਜਨਮਦਿਨ ਦੇ ਉੱਤੇ ਇੱਕ ਕੈਮਰਾ ਗਿਫਟ ਮਿਲੇਗਾ ਕੈਮਰਾ ਵੀ ਕੋਈ ਛੋਟਾ ਮੋਟਾ ਨਹੀਂ ਵੱਡਾ ਕੈਮਰਾ ਕਿਉਂਕਿ ਮੈਨੂੰ ਫੋਟੋਆਂ ਖਿੱਚਣ ਦਾ ਬਹੁਤ ਜ਼ਿਆਦਾ ਸ਼ੌਕ ਹੈ ਮੈਂ ਜਦੋਂ ਵੀ ਕਿਤੇ ਜਾਵਾਂ ਮੈਂ ਹਮੇਸ਼ਾ ਤਸਵੀਰਾਂ ਖਿੱਚਦੀ ਹੁੰਦੀ ਹਾਂ ਇਕੱਲੀਆਂ ਇਹ ਨਹੀਂ ਕਿ ਮੈਂ ਆਪਣੀਆਂ ਹੀ ਤਸਵੀਰਾਂ ਖਿੱਚਾਂ ਮੈਂ ਦੂਜਿਆਂ ਦੀਆਂ ਤਸਵੀਰਾਂ ਵੀ ਖਿੱਚਦੀ ਹਾਂ ਹੋਰ ਵੀ ਕਈ ਤਰ੍ਹਾਂ ਦੀਆਂ ਤਸਵੀਰਾਂ ਜਿਵੇਂ ਕੁਦਰਤ ਦੀਆਂ ਸੂਰਜ ਡੁੱਬਦਾ ਹੈ ਜਦੋਂ ਸੂਰਜ ਚੜ੍ਹਦਾ ਹੈ ਪੰਛੀਆਂ ਦੀਆਂ ਤਸਵੀਰਾਂ ਜਾਨਵਰਾਂ ਦੀਆਂ ਰੁੱਖਾਂ ਦੀਆਂ ਫੁੱਲਾਂ ਦੀਆਂ ਮੈਨੂੰ ਬਹੁਤ ਹੀ ਜ਼ਿਆਦਾ ਸ਼ੌਕ ਹੈ ਤਸਵੀਰਾਂ ਖਿੱਚਣ ਦਾ ਅਤੇ ਇਸ ਵਾਰ ਮੇਰਾ ਜਦੋਂ ਬਰਥਡੇ ਆਇਆ ਤਾਂ ਮੈਂ ਸੋਚਿਆ ਨਹੀਂ ਸੀਗਾ ਕਿ ਮੈਨੂੰ ਉਹ ਕੈਮਰਾ ਗਿਫਟ ਕਰਨਗੇ ਉਹਨਾਂ ਨੂੰ ਲੱਗਿਆ ਕਿ ਹਾਂ ਮੇਰੇ ਦੇ ਮੇਰੇ ਵਿੱਚ ਇਹ ਬਹੁਤ ਹੀ ਵੱਡੀ ਹੋਬੀ ਹੈ ਕਿ ਮੈਂ ਅੱਗੇ ਜਾ ਕੇ ਫੋਟੋਗ੍ਰਾਫਰ ਵੀ ਬਣ ਸਕਦੀ ਹਾਂ ਅਤੇ ਮੈਨੂੰ ਮੇਰੇ ਡੈਡੀ ਨੇ ਮੈਨੂੰ ਗਿਫਟ ਕੀਤਾ ਕੈਮਰਾ ਮੇਰੇ ਬਰਥਡੇ ਦੇ ਉੱਤੇ ਜਦੋਂ ਮੈਂ ਕੇਕ ਕੱਟ ਕੀਤਾ ਤਾਂ ਉਹਨਾਂ ਨੇ ਮੈਨੂੰ ਗਿਫਟ ਦਿੱਤਾ ਮੈਨੂੰ ਲੱਗਾ ਕਿ ਕੁਛ ਹੋਏਗਾ ਬਹੁਤ ਹੈਵੀ ਲੱਗਿਆ ਮੈਨੂੰ ਮੈਂ ਜਦੋਂ ਗਿਫਟ ਨੂੰ ਖੋਲ੍ਹਿਆ ਤਾਂ ਮੈਂ ਬਹੁਤ ਹੀ ਜ਼ਿਆਦਾ ਚੌਂਕ ਗਈ ਸੀਗੀ ਕਿ ਮੈਨੂੰ ਉਹਨਾਂ ਨੇ ਗਿਫਟ ਕੀ ਦਿੱਤਾ ਕਿ ਇੱਕ ਕੈਮਰਾ ਗਿਫਟ ਕੀਤਾ ਮੈਂ ਖੁਸ਼ੀ ਦੀ ਮਾਰੀ ਬਹੁਤ ਹੀ ਜ਼ਿਆਦਾ ਉਛੱਲ ਉੱਠੀ ਸੀ ਕਿਉਂਕਿ ਮੈਂ ਕਦੇ ਸੋਚਿਆ ਨਹੀਂ ਸੀਗਾ ਕਿਉਂਕਿ ਮੈਨੂੰ ਇੱਕ ਕੈਮਰਾ ਗਿਫਟ ਮਿਲੇਗਾ ਸੋ ਬਹੁਤ ਹੀ ਜ਼ਿਆਦਾ ਅਣਕਿਆਸੀ ਚੀਜ਼ ਸੀ ਮੇਰੇ ਲਈ ਇਹ ਅਤੇ ਫੋਟੋਆਂ ਖਿੱਚਣ ਦਾ ਹਰ ਇੱਕ ਦਾ ਆਪਣਾ ਆਪਣਾ ਢੰਗ ਹੁੰਦਾ ਮੈਂ ਵੀ ਫੋਟੋਆਂ ਖਿੱਚਦੀ ਹਾਂ ਸਭ ਤੋਂ ਪਹਿਲਾਂ ਮੈਂ ਦੇਖਦੀ ਹਾਂ ਕਿ ਮੈਂ ਫੋਟੋ ਜਿਸ ਚੀਜ਼ ਦੀ ਖਿੱਚਣੀ ਹੈ ਉਹ ਕਲੀਅਰ ਆ ਰਹੀ ਹੈ ਫੋਟੋ ਦੀ ਕਲੈਰਟੀ ਦੇਖਣੀ ਫੋਟੋ ਦਾ ਸਾਈਜ਼ ਦੇਖਣਾ ਕਿ ਸਾਰੇ ਪਾਸਿਓ ਫੋਟੋ ਦਾ ਸਾਈਜ਼ ਠੀਕ ਹੈ ਉੱਪਰੋਂ ਨੀਚੇਓਂ ਜੂਮ ਆਊਟ ਕਰਨਾ ਅਤੇ ਜੋ ਮੇਨ ਕੰਟੈਂਟ ਹੈ ਉਹਦੀ ਕਲੈਰਟੀ ਪੂਰੀ ਆ ਰਹੀ ਹੈ ਸੋ ਹਰ ਇੱਕ ਦਾ ਆਪਣਾ ਆਪਣਾ ਤਰੀਕਾ ਹੁੰਦਾ ਫੋਟੋਆਂ ਖਿੱਚਣ ਦਾ ਅਤੇ ਮੈਂ ਜੋ ਵੀ ਫੋਟੋਆਂ ਖਿੱਚਦੀ ਹਾਂ ਕੁਦਰਤ ਦੀਆਂ ਪੰਛੀਆਂ ਦੀਆਂ ਜਾਨਵਰਾਂ ਦੀਆਂ ਮੈਂ ਉਹ ਪੋਸਟ ਵੀ ਕਰ ਦਿੰਦੀ ਹਾਂ ਕਿਉਂਕਿ ਮੈਂ ਆਪਣਾ ਅਲੱਗ ਤੋਂ ਹੀ ਇੱਕ ਪੇਜ ਬਣਾਇਆ ਹੋਇਆ ਹੈ ਫੋਟੋਗ੍ਰਾਫੀ ਦੇ ਉੱਤੇ ਐਜ਼ ਕਿ ਮੈਨੂੰ ਫੋਟੋਗ੍ਰਾਫ ਕਰਨਾ ਬਹੁਤ ਵਧੀਆ ਲੱਗਦਾ ਸੋ ਉਹ ਪੇਜ ਦੇ ਉੱਤੇ ਮੈਂ ਹ ਅਕਸਰ ਹੀ ਜਦੋਂ ਕੋਈ ਤਸਵੀਰ ਨਵੀਂ ਖਿੱਚਦੀ ਹਾਂ ਅਤੇ ਉਹ ਮਨ ਨੂੰ ਮੇਰੇ ਭਾਉਂਦੀ ਹੈ ਤਾਂ ਮੈਂ ਉਹ ਪੋਸਟ ਕਰ ਦਿੰਦੀ ਹਾਂ ਅਤੇ ਬਹੁਤ ਵਧੀਆ ਵਿਊਜ਼ ਅਤੇ ਲਾਈਕ ਵੀ ਉਹਨਾਂ 'ਤੇ ਆਉਂਦੇ ਨੇ ਅਤੇ ਸਭ ਨੂੰ ਮੇਰੀਆਂ ਤਸਵੀਰਾਂ ਪਸੰਦ ਵੀ ਬਹੁਤ ਨੇ